ਜਾਨਵਰਾਂ ਪੌਦਿਆਂ ਅਤੇ ਭੋਜਨ ਫਾਈਬਰ ਬਾਇਓ ਕੂਲ ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਵਿੱਚ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ ਸੁਸਾਈਟੀ ਸੁਸਾਇਟੀ ਮਨੁੱਖੀ ਸੱਭਿਅਤਾ ਅਤੇ ਉੱਤਰਾ ਅਧਿਕਾਰ ਅਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ ਜਿਸ ਵਿੱਚ ਫਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਕਿ ਪੈਦਾ ਕੀਤੀ ਗਈ ਜੋ ਕਿ ਸੱਭਿਆਚਾਰ ਦੇ ਵਿਕਾਸ ਅਤੇ ਉਸਤਤਾ ਉਤਸ਼ਾਹਿਤ ਕਰਦੀ ਸੀ ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਬਣਾਇਆ ਹੁੰਦਾ ਹੈ ਅਤੇ ਇਸ ਵਿਕਾਸ ਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ ਵੱਖਰੇ ਮਾਹੌਲ ਸੱਭਿਆਚਾਰਾਂ ਅਤੇ ਤਕਨੋਲੋਜੀ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ ਵੱਡੀ ਕਿ ਪੱਧਰ ਉੱਤੇ ਮਨੋ ਕਲਪ ਮਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਭ ਮੁਖੀ ਖੇਤੀਬਾੜੀ ਵਧੀ ਹੈ ਆਧੁਨਿਕ ਪੰਨ ਖੇਤੀਬਾੜੀ ਪਲਾਟ ਬਿਲਡਿੰਗ ਐਰੀ ਐਗਰੀਕੋਮੀਕਲ ਟੀਕਾ ਨਾ ਕੀਟਨਾਸ਼ਕਾਂ ਖਾਦਾਂ ਅਤੇ ਤਕਨੀਕੀ ਵਿਗਿਆਨ ਦੀ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ ਪਰ ਉਸ ਸਮੇਂ ਵਿਆਪਕ ਵਾਤਾਵਰਣ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਵਿਭਾਗ ਪਾ ਭਾਵਾਂ ਦਾ ਕਾਰਨ ਵੀ ਸਾਹਮਣੇ ਆਇਆ ਹੈ ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਾ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ ਕੀਤਾ ਹੈ